ਨਮਸਕਾਰ ਜੀ ਮੇਰਾ ਨਾਮ ਪੂਜਾ ਦੇਵੀ ਹੈ ਅਤੇ ਮੈਂ ਪਠਾਨਕੋਟ ਦੀ ਰਹਿਣ ਵਾਲੀ ਹਾਂ ਪਠਾਨਕੋਟ ਦੇ ਨਾਲ ਪਿੰਡ ਢੇਸੀਆਂ ਪੈਂਦਾ ਹੈ ਇੱਥੇ ਜ਼ਿਆਦਾਤਰ ਲੋਕ ਕਿਰਾਏ 'ਤੇ ਕਮਰੇ ਘੱਟ ਹੀ ਦਿੰਦੇ ਹਨ ਅਤੇ ਜੇਕਰ ਅਸੀਂ ਸ਼ਹਿਰ ਦੀ ਗੱਲ ਕਰੀਏ ਤਾਂ ਉੱਥੇ ਪਠਾਨਕੋਟ ਦੇ ਵਿੱਚ ਹਜ਼ਾਰ ਰੁਪਏ ਕਿਰਾਏ ਸ਼ੁਰੂ ਹੈ ਧੰਨਵਾਦ